ਅੱਜ ਦੇ ਯੁੱਗ ਵਿੱਚ ਮੀਡੀਆ ਸਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਮੀਡੀਆ ਦੇ ਜ਼ਰੀਏ ਅਸੀਂ ਇੱਕ ਸ਼ਹਿਰ ਦੀ ਜਾਣਕਾਰੀ ਦੂਜੇ ਸ਼ਹਿਰ ਤੱਕ ਪਹੁੰਚਾ ਸਕਦੇ ਹਾਂ ਜਾਂ ਇਹ ਕਹਿ ਲਓ ਵੀ ਇੱਕ ਥਾਂ ਤੋਂ ਦੂਜੀ ਥਾਂ ਤੱਕ ਆਪਣੀ ਗੱਲ ਨੂੰ ਪਹੁੰਚਾ ਸਕਦੇ ਹਾਂ ਮੀਡੀਆ ਸਥਾਨਕ ਖ਼ਬਰਾਂ ਦੀ ਕਵਰੇਜ ਵੀ ਕਰਦਾ ਹੈ ਅਤੇ ਇਸ ਨਾਲ ਕੀ ਹੁੰਦਾ ਹੈ ਸਾਰੀ ਜਾਣਕਾਰੀ ਆਲ ਓਵਰ ਸਾਰੇ ਕਿਤੇ ਫੈਲ ਜਾਂਦੀ ਹੈ ਮੀਡੀਆ ਨੂੰ ਚਾਹੀਦਾ ਹੈ ਕਿ ਉਹ ਜੋ ਵੀ ਕਵਰੇਜ ਕਰ ਰਿਹਾ ਹੈ ਉਹ ਸਹੀ ਅਤੇ ਸਟੀਕ ਹੋਵੇ ਤਾਂ ਜੋ ਲੋਕਾਂ ਤੱਕ ਇਸ ਦੀ ਸਹੀ ਦੇ ਸਟੀਕ ਜਾਣਕਾਰੀ ਪਹੁੰਚ ਸਕੇ ਖ਼ਬਰ ਜੋ ਵੀ ਹੈ ਉਹ ਮੀਡੀਆ ਨੂੰ ਸਹੀ ਲਗਾਉਣੀ ਚਾਹੀਦੀ ਹੈ ਜਿਵੇਂ ਕਿ ਕਿਸੇ ਦੁਰਘਟਨਾ ਦੀ ਖ਼ਬਰ ਹੋ ਗਈ ਜਾਂ ਕਿਸੇ ਕਰਪਸ਼ਨ ਮਾਮਲੇ ਦੀ ਖ਼ਬਰ ਹੋ ਗਈ ਇਹ ਜਾਣਕਾਰੀ ਮੀਡੀਆ ਨੂੰ ਸਹੀ ਤਰੀਕੇ ਨਾਲ ਕਵਰੇਜ ਕਰਕੇ ਲੋਕਾਂ ਤੱਕ ਪਹੁੰਚਾਉਣੀ ਚਾਹੀਦੀ ਹੈ ਕਈ ਖ਼ਬਰਾਂ ਜੋ ਮੀਡੀਆ ਤੋਂ ਗੁੰਮ ਹੋ ਚੁੱਕੀਆਂ ਹਨ ਉਹਨਾਂ ਵੱਲ ਵੀ ਮੀਡੀਆ ਨੂੰ ਵਿਸ਼ੇਸ਼ ਧਿਆਨ ਦੇ ਕੇ ਉਹਨਾਂ ਦੀ ਕਵਰੇਜ ਕਰਨੀ ਚਾਹੀਦੀ ਹੈ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣੀ ਚਾਹੀਦੀ ਹੈ ਤਾਂ ਜੋ ਲੋਕ ਇਸ ਤੋਂ ਜਾਣੂ ਹੋ ਸਕਣ